ਹਾਂਜੀ ਪੰਜਾਬ ਦਾ ਮਸ਼ਹੂਰ ਖਾਣਾ ਸਾਗ ਮੱਕੀ ਦੀ ਰੋਟੀ ਹੈ ਨਾਲ ਲੱਸੀ ਇਹ ਮੈਂ ਬਣਾ ਕੇ ਬਹੁਤ ਚੰਗੀ ਤਰ੍ਹਾਂ ਬਣਾ ਲੈਂਦੀ ਹਾਂ ਇਸ ਨੂੰ ਇਹ ਤਿੰਨ ਤਰ੍ਹਾਂ ਦਾ ਬਣਦਾ ਹੈ ਰਾਏ ਦਾ ਬਣਦਾ ਹੈ ਸਰ੍ਹੋਂ ਦਾ ਬਣਦਾ ਹੈ ਅਤੇ ਪਾਲਕ ਦਾ ਵੀ ਬਣ ਜਾਂਦਾ ਹੈ ਇਸ ਨੂੰ ਪਹਿਲਾਂ ਧੋਇਆ ਜਾਂਦਾ ਹੈ ਫਿਰ ਚੀਰਿਆ ਜਾਂਦਾ ਹੈ ਫਿਰ ਚੀਰ ਕੇ ਚ ਤੌੜੀ ਵਿੱਚ ਪਾ ਕੇ ਦੋ ਗਿਲਾਸ ਪਾਣੀ ਦੇ ਪਾ ਕੇ ਇਹ ਰਿਝ ਰਿੱਝਾਇਆ ਜਾਂਦਾ ਹੈ ਵਿੱਚ ਲੂਣ ਪਾ ਕੇ ਵਿੱਚ ਲਸਣ ਪਾ ਕੇ ਇਹ ਰਿੱਝਾ ਕੇ ਇਸ ਨੂੰ ਫੇਰ ਘੋਟਣੇ ਨਾਲ ਘੋਟਿਆ ਜਾਂਦਾ ਹੈ ਫੇਰ ਅਲੱ ਫੇਰ ਇਸਨੂੰ ਮੱਕੀ ਦਾ ਆਟਾ ਪਾ ਕੇ ਘੋਟ ਘੋਟ ਕੇ ਫੇਰ ਇਹ ਅੱਗ ਦੇ ਉੱਤੇ ਰੱਖ ਕੇ ਦੁਬਾਰਾ ਸਜਾਇਆ ਜਾਂਦਾ ਹੈ ਇਸ ਲਈ ਇਸ ਨੂੰ ਅਲੱਗ ਤੜਕਾ ਲਗਾ ਕੇ ਪਿਆਜ਼ ਲਸਣ ਅਦਰਕ ਵਗੈਰਾ ਪਾ ਕੇ ਤੜਕਾ ਲਗਾਇਆ ਜਾਂਦਾ ਹੈ ਫੇਰ ਉਹ ਇਸ ਵਿੱਚ ਪਾਇਆ ਜਾਂਦਾ ਹੈ